ਫੁਲਕਾਰੀ ਪੰਜਾਬ ਦੀ ਇੱਕ ਪ੍ਰਸਿੱਧ ਕਢਾਈ ਅਤੇ ਕਲਾ ਹੈ ਜੋ ਕਿ ਖਾਸ ਤੌਰ 'ਤੇ ਦੁਪੱਟਿਆਂ ਸ਼ੋਲਾਂ ਅਤੇ ਕੁਛ ਹੋਰ ਪਹਿਨਾਵਿਆਂ 'ਤੇ ਕੀਤੀ ਜਾਂਦੀ ਹੈ ਇਹ ਕਲਾ ਜ਼ਿਆਦਾਤਰ ਪੰਜਾਬ ਦੇ ਪਿੰਡਾਂ ਵਿੱਚ ਔਰਤਾਂ ਦੁਆਰਾ ਆਪਣੇ ਹੱਥਾਂ ਨਾਲ ਕੀਤੀ ਜਾਂਦੀ ਸੀ ਪਰ ਹੁਣ ਇਹ ਵਪਾਰਿਕ ਤੌਰ 'ਤੇ ਵੀ ਉਤਪਾਦਿਤ ਹੋ ਰਹੀ ਹੈ ਫੁਲਕਾਰੀ ਵਿੱਚ ਰੰਗ ਬਿਰੰਗੇ ਧਾਗਿਆਂ ਦੀ ਵਰਤੋਂ ਕਰਕੇ ਵੱਖ ਵੱਖ ਡਿਜ਼ਾਈਨਾਂ ਨਾਲ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਫੁੱਲ ਪੱਤੇ ਅਤੇ ਉਹ ਪੋਤਕਲੇ ਨਕਸ਼ੇ ਇਹ ਜ਼ਿਆਦਾਤਰ ਖੱਦਰ ਜਾਮਾ ਪਰ ਜਾਂ ਰੂੰਈਂ ਦੇ ਕੱਪੜਿਆਂ 'ਤੇ ਬਣਾਈ ਜਾਂਦੀ ਹੈ ਪੁਰਾਣੇ ਸਮਿਆਂ ਵਿੱਚ ਫੁਲਕਾਰੀ ਇੱਕ ਵਿਆਹ ਸ਼ੁਭ ਮੰਨਿਆ ਜਾਂਦਾ ਸੀ ਅਤੇ ਇਸ ਨੂੰ ਵਿਆਹ ਸ਼ਾਦੀਆਂ ਵਿੱਚ ਵਿਅਕਤੀਆਂ ਨੂੰ ਤੋਹਫੇ ਵਜੋਂ ਦਿੱਤਾ ਜਾਂਦਾ ਸੀ ਅੱਜ ਵੀ ਪੰਜਾਬੀ ਪਹਿਰਾਵਿਆਂ ਵਿੱਚ ਫੁੱਲਕਾਰੀ ਦੀ ਇੱਕ ਵੱਖਰੀ ਸ਼ਾਨ ਹੈ ਅਤੇ ਲੋਕ ਵਿੱਚ ਨੂੰ ਖਾਸ ਤਿਉਹਾਰਾਂ 'ਤੇ ਸਮਰਾ ਸਮਾਰੋਹਾਂ ਵਿੱਚ ਪਹਿਨਦੇ ਹਨ